ਮੈਂ ਫਾਜ਼ਿਲਕਾ ਖੇਤਰ ਦੀ ਨਿਵਾਸੀ ਹਾਂ ਇਸ ਖੇਤਰ ਵਿੱਚ ਰੇਤ ਬਹੁਤ ਜ਼ਿਆਦਾ ਮਿਲਦੀ ਹੈ ਰੇਤਾਂ ਦੇ

ਕੀ ਕਹਿੰਦੇ ਉਸ ਨੂੰ ਸਿੱਲੀਆਂ ਦੀਆਂ ਸਿੱਲੀਆਂ ਜ਼ਮੀਨ 'ਚੋਂ ਨਿਕਲਦੀਆਂ ਹਨ ਔਰ ਰੇਤ ਆਪਾਂ ਸਭ ਜਾਣਦੇ ਹਾਂ ਕਿ ਜਿੱਥੇ ਵੀ ਕੋਈ ਵੀ ਇਮਾਰਤ ਉਸਾਰੀ ਜਾਂਦੀ ਹੈ ਉਸ ਦੇ ਵਿੱਚ ਸੀਮੈਂਟ ਤਾਂ ਜ਼ਰੂਰਤ ਹੁੰਦੀ ਹੈ ਲੇਕਿਨ ਇੱਕ ਪੋਰਸ਼ਨ ਰੇਤ ਦਾ ਵੀ ਜ਼ਰੂਰੀ ਹੈ ਬਿਨਾ ਉਸਦੇ ਇਮਾਰਤ ਖੜ੍ਹੀ ਨਹੀਂ ਹੋ ਸਕਦੀ ਸੋ ਕਿਸੇ ਵੀ ਕਿਸੇ ਤਰ੍ਹਾਂ ਦੀ ਵੀ ਇਮਾਰਤ ਹੋਏ ਭਾਵੇਂ ਦੁਕਾਨ ਹੈ ਭਾਵੇਂ ਆਫਿਸਸ ਨੇ ਭਾਵੇਂ ਘਰ ਨੇ ਆਪਾਂ ਜਿੱਥੇ ਵੀ ਰਹਿੰਦੇ ਹਾਂ ਉੱਥੇ ਇਮਾਰਤਾਂ ਦੀ ਤਾਂ ਜ਼ਰੂਰਤ ਹੈ ਹੀ ਔਰ ਜਿਹੜੀ ਵੀ ਇਮਾਰਤ ਉਸਾਰੀ ਜਾਵੇਗੀ ਉਹਦੇ ਵਿੱਚ ਰੇਤ ਦੀ ਜ਼ਰੂਰਤ ਹੋਏਗੀ ਸੋ ਇਸ ਇਲਾਕੇ ਦੀ ਰੇਤ ਇੱਥੇ ਤਾਂ ਵਰਤੀ ਹੀ ਜਾਂਦੀ ਹੈ ਇਹ ਬਾਹਰ ਪੂਰੇ ਦੇਸ਼ 'ਚ ਹੋਰ ਖੇਤਰਾਂ 'ਚ ਵੀ ਭੇਜੀ ਜਾਂਦੀ ਹੈ